ਸਾਡੇ ਆਪਣੇ ਤਿਉਹਾਰ ਜਿਵੇਂ ਕਿ ਵਿਸਾਖੀ ਦੇ ਮੌਕੇ 'ਤੇ ਵੀ ਲੋਕ ਡਾਂਸ ਕਰਦੇ ਗਿੱਧਾ ਪਾਉਂਦੇ ਹੈਗੇ ਅਤੇ ਇਸ ਤੋਂ ਇਲਾਵਾ ਨਵੇਂ ਸਾਲ ਦੇ ਆਉਣ ਦੀ ਖੁਸ਼ੀ 'ਚ ਵੀ ਲੋਕਾਂ ਵੱਲੋਂ ਗਾਣੇ ਲਾ ਕੇ ਡਾਂਸ ਕੀਤਾ ਜਾਂਦਾ ਭੰਗੜਾ ਪਾਇਆ ਜਾਂਦਾ ਗਿੱਧਾ ਪਾਇਆ ਜਾਂਦਾ ਹੈਗਾ ਇਸ ਤੋਂ ਇਲਾਵਾ ਆਪਣੀ ਬ ਬਸਾ ਲੋਹੜੀ ਨੂੰ ਵੀ ਲੋਹੜੀ ਨੂੰ ਵੀ ਲੋਹੜੀ ਦੀ ਜਦੋਂ ਬੱਚਾ ਜਨਮ ਲੈਂਦਾ ਗਾ ਤਾਂ ਉਹਦੀ ਪਹਿਲੀ ਲੋਹੜੀ 'ਤੇ ਵੀ ਲੋਕਾਂ ਵੱਲੋਂ ਡੀ ਜੇ ਲਾ ਕੇ ਡਾਂਸ ਕੀਤਾ ਜਾਂਦਾ ਗਾ ਆਪਦੀ ਮਨਪਸੰਦ ਦੇ ਪਕਵਾਨ ਵੀ ਬਣਾਏ ਜਾਂਦੇ ਹੈਗੇ ਅਤੇ ਇੰਜੋਏ ਕੀਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਧੀਆਂ ਆ ਗਈਆਂ ਸਾਵਣ 'ਚ ਉਦੋਂ ਵੀ ਲੋਕਾਂ ਵੱਲੋਂ ਆਪਣੀ ਡਾਂਸ ਕੀਤਾ ਜਾਂਦਾ ਭੰਗੜਾ ਕੁੜੀਆਂ ਮਹਿੰਦੀ ਲਾਉਂਦੀਆਂ ਚੂੜੀਆਂ ਪਾਉਂਦੀਆਂ ਨੇ ਅਤੇ ਗਿੱਧਾ ਪਾਉਣ ਜਾਂਦੀਆਂ ਨੇਗੀਆਂ ਤੀ ਤੀਜ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਆਉਣ ਉਸ ਦਿਨਾਂ 'ਚ ਗਿੱਧਾ ਪਾਇਆ ਜਾਂਦਾ ਹੈਗਾ ਅਤੇ ਇਸ ਤੋਂ ਇਲਾਵਾ ਬੱਚੇ ਦੀ ਪਹਿਲੇ ਜਨਮ ਦਿਨ ਦੀ ਖੁਸ਼ੀ 'ਤੇ ਵੀ ਲੋਕਾਂ ਵੱਲੋਂ ਆਪਦੇ ਬੱਚੇ ਦੀ ਖੁਸ਼ੀ ਹੋਣ ਜਨਮ ਦਿਨ ਦੀ ਖੁਸ਼ੀ 'ਚ ਡੀ ਜੇ ਲਾ ਕੇ ਗਿੱਧਾ ਪਾਇਆ ਜਾਂਦਾ ਅਤੇ ਕੇਕ ਕੱਟਿਆ ਜਾਂਦਾ ਹੈਗਾ ਅਤੇ ਭੰਗੜਾ ਪਾਇਆ ਜਾਂਦਾ ਹੈਗਾ ਡਾਂਸ ਵੀ ਕੀਤਾ ਜਾਂਦਾ ਗਾਣੇ ਲਾ ਕੇ ਇਸ ਤੋਂ ਇਲਾਵਾ ਵਧੀਆ ਲੱਗਦਾ ਲੋਕ ਇੰਨੇ ਨਾਲ ਖੁਸ਼ ਹੋ ਜਾਂਦੇ ਆ ਅੱਜ ਕੱਲ੍ਹ ਲੋਕਾਂ ਦੀ ਜੋ ਜ਼ਿੰਦਗੀ ਜ਼ਿਆਦਾ ਟੈਨਸ਼ਨਾਂ ਭਰੀ ਹੈ ਅਤੇ ਉਹ ਜਦੋਂ ਕੋਈ ਖਾਸ ਪ੍ਰੋਗਰਾਮ ਦੇ ਹੁੰਦੇ ਤਾਂ ਉਹਦੇ ਨੱਚ ਕੇ ਆਪਣਾ ਮਨ ਸ਼ਾਂਤ ਕਰ ਲੈਂਦੇ ਹੈਗੇ ਇਸ ਨਾਲ ਉਹਨਾਂ ਨੂੰ ਹੋਰ ਵੱਖਰਾ ਮਾਹੌਲ ਮਿਲ ਜਾਂਦਾ ਹੈਗਾ ਖੁਸ਼ੀਆਂ ਭਰਿਆ ਮਾਹੌਲ ਮਿਲ ਜਾਂਦਾ ਗਾ ਅਤੇ ਸਾਡੇ ਜਿਵੇਂ ਹੋ ਗਿਆ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਲੋਹੜੀ ਹੋ ਗਈ ਅਤੇ ਸਾਵਣ 'ਚ ਤੀਆਂ ਹੋ ਗਈਆਂ ਬੱਚੇ ਦੀ ਖੁਸ਼ੀ ਹੋ ਗਈ ਵਿਆਹ ਹੋ ਗਈ ਵਿਆਹ ਦੇ ਵਿੱਚ ਵੀ ਡਾਂਸ ਕੀਤਾ ਜਾਂਦਾ ਗਾ ਪਹਿਲਾਂ ਜਾਗੋ ਬਣਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਬੱਚਾ ਜੇ ਕੋਈ ਬੇਟੇ ਦਾ ਵਿਆਹ ਤਾਂ ਬੇਟਾ ਵਿਆਹ ਕੇ ਲਿਆਉਂਦਾ ਹੈ ਅਤੇ ਉਹ ਉਹਨਾਂ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਵਿਆਹ ਕੇ ਲਿਆਉਣ ਦੀ ਖੁਸ਼ੀ 'ਚ ਵੀ ਗਿੱਧਾ ਪਾਇਆ ਜਾਂਦਾ ਗਾ ਡੀ ਜੇ ਲਾਏ ਜਾਂਦੇ ਆ ਅਤੇ ਨੱਚਿਆ ਜਾਂਦਾ ਜੋੜੀ ਨੂੰ ਨਚਾਇਆ ਜਾਂਦਾ ਆਪ ਨੱਚਦੇ ਲੋਕ ਅਤੇ ਬਹੁਤ ਇੰਜੋਏ ਕਰਦੇ ਆ